ਹੈਲੋ ਹਾਂਜੀ ਮੇਰਾ ਨਾਮ ਨੀਰੂ ਹੈ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਸਿਲਾਈ ਦੇ ਬਾਰੇ ਦੱਸਣ ਜਾ ਰਹੀ ਹਾਂ ਔਰ ਸਿਲਾਈ ਦੇ ਬਾਰੇ ਇਹ ਦੱਸਣ ਜਾ ਰਹੀ ਹਾਂ ਕਿ ਜਿਹੜੀ ਆਪ ਅਸੀਂ ਘਰ ਵਿੱਚ ਕੱਪੜੇ ਸਿਉਂਦੇ ਹਾਂ ਔਰ ਬਾਜ਼ਾਰ ਰੈਡੀਮੇਟ ਕੱਪੜੇ 'ਚ ਕੀ ਅੰਤਰ ਹੁੰਦਾ ਹੈ ਜਿਹੜੀ ਅਸੀਂ ਘਰ ਤੇ ਕੱਪੜੇ ਸਿਉਂਦੇ ਹਾਂ ਉਹ ਮਤਲਬ ਕਿ ਬਹੁਤ ਵਧੀਆ ਅਸੀਂ ਆਪਣੀ ਸਟਿਚਿੰਗ ਕਰਦੇ ਹਾਂ ਔਰ ਅੱਛੇ ਹੀ ਧਾਗੇ ਇਸਤੇਮਾਲ ਕਰਦੇ ਹਾਂ ਮਤਲਬ ਕਿ ਬਹੁਤ ਰੇ ਅੱਛੇ ਤਰੀਕੇ ਦੇ ਨਾਲ ਡਿਜ਼ਾਇਨਰ ਸੂਟ ਅਸੀਂ ਤਿਆਰ ਕਰਦੇ ਹਾਂ ਮਤਲਬ ਕਿ ਲੋਕ ਬਹੁਤ ਹੀ ਉਹਨੂੰ ਜ਼ਿਆਦਾ ਪਸੰਦ ਕਰਦੇ ਹੈ ਔਰ ਜਿਹੜੀ ਆਪਣੀ ਕਿ ਅਸੀਂ ਰੈਡੀਮੇਡ ਸੂਟ ਲੈਂਦੇ ਹਾਂ ਉਹਨਾਂ ਦੀਆਂ ਸਿਲਾਈਆਂ ਜਿਹੜੀਆਂ ਹੁੰਦੀਆਂ ਉਹ ਕੱਚੀਆਂ ਹੁੰਦੀਆਂ ਜਿਸ ਕਰਕੇ ਸਾਨੂੰ ਮਤਲਬ ਕਿ ਉਹ ਅੱਛੇ ਮਤਲਬ ਕਿ ਨਹੀਂ ਲੱਗਦੇ ਮਤਲਬ ਕਿ ਜ ਕਾਫ਼ੀ ਮਤਲਬ ਕਿ ਇਸ ਤਰ੍ਹਾਂ ਦੇ ਸੂਟ ਹੁੰਦੇ ਆ ਦੇਖਣ 'ਚ ਤਾਂ ਉਹ ਬਹੁਤ ਵਧੀਆ ਲੱਗਦੇ ਆ ਪਰ ਜਦੋਂ ਅਸੀਂ ਮਤਲਬ ਕਿ ਉਹਨੂੰ ਇਸਤੇਮਾਲ ਕਰਦੇ ਹਾਂ ਉਹ ਕਾਫ਼ੀ ਮਤਲਬ ਕਿ ਖਰਾਬ ਸਾਨੂੰ ਉਹਦੇ ਸਿਉਣਾ ਉੱਧੜ ਜਾਣਗੀਆਂ ਕੱਚੀਆਂ ਸਿਉਣਾ ਹੁੰਦੀਆਂ ਇਸ ਕਰਕੇ ਮਤਲਬ ਕਿ ਸਾਨੂੰ ਬਹੁਤ ਮਤਲਬ ਜਿਹੜੀ ਘਰ ਦੀ ਆਪੇ ਹੀ ਸਿਲਾਈ ਕਰਦੇ ਹਾਂ ਉਹ ਅਸੀਂ ਅੱਛੇ ਤਰੀਕੇ ਦੇ ਨਾਲ ਤਿਆਰ ਕਰਦੇ ਹਾਂ ਔਰ ਅੱਛਾ ਧਾਗਾ ਉਹਦੇ 'ਚ ਅਸੀਂ ਇਸਤੇਮਾਲ ਕਰਦੇ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਉਹਨੂੰ ਅੱਛੇ ਡਿਜ਼ਾਇਨਰ ਦੇ ਨਾਲ ਤਿਆਰ ਕਰਦੇ ਹਾਂ ਔਰ ਇਹ ਬੁਣਾਈ ਦੇ ਜਿਹੜਾ ਕੰਮ ਹੈ ਮਤਲਬ ਜਿਹੜੀ ਅਸੀਂ ਸਿਲਾਈਆਂ ਮਤਲਬ ਕਿ ਬਣਾਉਂਦੇ ਹਾਂ ਅਸੀਂ ਜੋ ਵੀ ਸਵੈਟਰ ਮਤਲਬ ਕਿ ਮੈਂ ਜਿਹੜੀ ਅਸੀਂ ਤਿਆਰ ਕਰਦੇ ਹਾਂ ਆਪਣੀ ਹੱਥ ਦੇ ਨਾਲ ਤਿਆਰ ਕਰਦੇ ਹਾਂ ਉਹ ਲੋਕ ਬਹੁਤ ਹੀ ਜ਼ਿਆਦਾ ਉਹਨੂੰ ਪਸੰਦ ਕਰਦੇ ਹੈ ਜਿਸ ਤਰ੍ਹਾਂ ਮਤਲਬ ਕਿ ਮੈਂ ਸਵੈਟਰ ਵਗੈਰਾ ਬੱਚਿਆਂ ਦੇ ਸੈਟ ਹੋ ਗਏ ਹੋਰ ਕਈ ਤਰ੍ਹਾਂ ਦੀਆਂ ਝੂਲੇ ਜਿਸ ਬੱਚੇ ਨੂੰ ਅਸੀਂ ਪਾਉਂਦੇ ਹਾਂ ਸ਼ਰੁਗ ਹੋ ਗਈ ਇਸ ਤਰ੍ਹਾਂ ਦੀ ਅਸੀਂ ਤਿਆਰ ਕਰਦੇ ਹਾਂ ਲੋਕ ਉਹਨੂੰ ਕਾਫ਼ੀ ਅੱਛੇ ਡਿਜ਼ਾਇਨ ਦੇ ਨਾਲ ਅਸੀਂ ਤਿਆਰ ਕਰਦੇ ਹਾਂ ਔਰ ਲੋਕ ਉਹਨੂੰ ਕਾਫ਼ੀ ਅੱਛਾ ਪਸੰਦ ਕਰਦੇ ਹੈ ਉਹ ਜੋ ਬਾਜ਼ਾਰ ਦੀਆਂ ਹੁੰਦੀਆਂ ਉਹ ਅਸੀਂ ਆਪਣੇ ਮਨ ਮਤਲਬ ਸਾਡੀ ਪਸੰਦ ਦੇ ਨਾ ਹੋਣ ਦੇ ਵੀ ਜਦੋਂ ਅਸੀਂ ਉਸ ਨੂੰ ਖਰੀਦਦੇ ਹਾਂ ਅਤੇ ਉਹਦੇ ਵਿੱਚ ਮਤਲਬ ਜੋ ਵੀ ਹੁੰਦਾ ਬੁਣਾਈ ਹੁੰਦੀ ਹੈ ਉਹ ਮਤਲਬ ਕਿ ਮਸ਼ੀਨੀ ਹੁੰਦੀ ਹੈ ਮਸ਼ੀਨ ਮਸ਼ੀਨਰੀ ਨਾਲ ਜਿਹੜੇ ਸਵੈਟਰ ਬਣਾਉਣੇ ਔਰ ਹੱਥ ਦੇ ਨਾਲ ਸਵੈਟਰ ਜਿਹੜੇ ਬਣਾਉਣੇ ਉਹਦੇ ਵਿੱਚ ਸਾਡਾ ਜਮੀਨ ਆਸਮਾਨ ਦਾ ਫ਼ਰਕ ਹੁੰਦਾ ਮਤਲਬ ਅਸੀਂ ਜਿਹੜੇ ਆਪਣੇ ਹੱਥ ਦੇ ਨਾਲ ਸਵੈਟਰ ਬਣਾਉਂਦੇ ਹਾਂ ਕਾਫ਼ੀ ਅੱਛੇ ਤਰੀਕੇ ਦੇ ਨਾਲ ਮਤਲਬ ਬਹੁਤ ਹੀ ਸਫਾਈ ਦੇ ਨਾਲ ਉਹਨੂੰ ਅਸੀਂ ਤਿਆਰ ਕਰਦੇ ਹਾਂ ਜਿਵੇਂ ਕਿ ਅੱਛੇ ਡਿਜ਼ਾਇਨ ਉਹਦੇ ਵਿੱਚ ਅਸੀਂ ਮਤਲਬ ਪਾਉਂਦੇ ਹਾਂ ਹਰ ਤਰ੍ਹਾਂ ਦੇ ਮਤਲਬ ਕਲਰ ਡਿਜ਼ਾਇਨਰ ਔਰ ਲੋਕ ਉਹਨੂੰ ਕਾਫ਼ੀ ਮਤਲਬ ਵੀ ਪਸੰਦ ਕਰਦੇ ਹਾਂ ਮਤਲਬ ਕਾਫ਼ੀ ਦੂਰ ਦੂਰ ਤੋਂ ਲੋਕ ਆਉਂਦੇ ਆ ਜੇ ਮਤਲਬ ਵੀ ਮੇਰੇ ਕੋਲ ਇਹ ਚੀਜ਼ਾਂ ਸ਼ਰੁਗ ਵਗੈਰਾ ਹੋ ਗਈਆਂ ਝੂਲੇ ਹੋ ਗਈ ਬੱਚਿਆਂ ਦੇ ਛੋਟੇ ਸੈਟ ਹੋ ਗਏ ਔਰ ਲੇਡੀ ਸਵੈਟਰਾਂ ਹੋ ਗਈਆਂ ਔਰ ਜੈਂਟਸ ਹੋ ਗਈਆਂ ਹਰ ਤਰ੍ਹਾਂ ਦੀ ਮਤਲਬ ਕਿ ਮਤਲਬ ਕਿ ਅਸੀਂ ਤਿਆਰ ਕਰਦੇ ਹਾਂ ਜੋ ਲੋਕ ਮਤਲਬ ਕਿ ਕੋ ਉਹਨੂੰ ਕਾਫ਼ੀ ਪਸੰਦ ਕਰਦੇ ਆ ਮਤਲਬ ਅੱਛੇ ਡਿਜ਼ਾਇਨ ਦੇ ਨਾਲ ਅਸੀਂ ਤਿਆਰ ਕਰਦੇ ਹਾਂ ਔਰ ਮਤਲਬ ਜੋ ਰੈਡੀਮੇਡ ਹੁੰਦੇ ਆ ਉਹ ਮਤਲਬ ਕਿ ਸਾਡੇ ਮਤਲਬ ਕਿ ਇੰਨੇ ਸਾਨੂੰ ਉਹ ਪਸੰਦ ਨਹੀਂ ਆਉਂਦੇ ਫਿਰ ਵੀ ਮਤਲਬ ਕਿ ਅੱਛੇ ਮਤਲਬ ਕਿ ਅਸੀਂ ਖੁਦ ਹੀ ਤਿਆਰ ਉਹਨੂੰ ਘਰ ਕਰ ਸਕਦੇ ਹਾਂ ਜਿ ਜਿਸ ਵਿਚ ਮਤਲਬ ਕਿ ਕਾਫ਼ੀ ਮਤਲਬ ਕਿ ਹੋਰ ਵੀ ਕਈ ਤਰੀਕਿਆਂ ਦੇ ਹੁੰਦੇ ਆ ਡਿਜ਼ਾਇਨ ਮਤਲਬ ਜਿਸ ਤਰ੍ਹਾਂ ਸ਼ੋਲ ਵੀ ਅਸੀਂ ਮਤਲਬ ਕਿ ਸਵੈਟਰ ਦੇ ਉੱਨ ਦੇ ਨਾਲ ਅਸੀਂ ਤਿਆਰ ਕਰਦੇ ਹਾਂ ਔਰ ਉੱਨ ਦੇ ਨਾਲ ਅਸੀਂ ਖਰੋਸ਼ੀਆ ਦਾ ਵੀ ਵਿੱਚ ਮਤਲਬ ਕਿ ਅਸੀਂ ਕੰਮ ਕਰਦੇ ਹਾਂ ਜਿਹਦੇ ਵਿੱਚ ਮਤਲਬ ਮਫਲਰ ਹੋ ਗਏ ਸੋਲ ਹੋ ਗਈ ਇਹ ਕਾਫ਼ੀ ਮਤਲਬ ਸਿਲਾਈਆਂ ਦੇ ਨਾਲ ਵੀ ਤਿਆਰ ਹੋ ਸਕਦੇ ਆ ਅੱਛੇ ਡਿਜਾਈਨ ਦੇ ਨਾਲ ਔਰ ਖਰੋਸ਼ੀਏ ਦੇ ਨਾਲ ਵੀ ਮੈਂ ਮਤਲਬ ਕਿ ਤਿਆਰ ਕਰਦੀ ਹਾਂ ਕਾਫ਼ੀ ਅੱਛੇ ਤਰੀਕੇ ਦੇ ਨਾਲ ਮਤਲਬ ਉਹਨੂੰ ਮਤਲਬ ਕਿ ਕਰਦੇ ਹਾਂ ਇਸ ਕਰਕੇ ਸਾਨੂੰ ਮਤਲਬ ਕਿ ਇਹਦੇ ਵਿੱਚ ਇਹ ਅੰਤਰ ਹੈ ਕਿ ਜਿਹੜੇ ਅਸੀਂ ਆਪਣੇ ਮਤਲਬ ਸਿਲਾਈ ਹੁੰਦੇ ਮਤਲਬ ਜਿਹੜੇ ਸੂਟ ਆ

ਕੋਈ ਖੁਲ੍ਹੇ ਹੁੰਦੇ ਆ ਜਦੋਂ ਕਿ ਜਿਸ ਤਰ੍ਹਾਂ ਵੀ ਹੁੰਦੇ ਸਾਨੂੰ ਮਤਲਬ ਉਹਦੀ ਫਿਟਿੰਗ ਵਗੈਰਾ ਕਰਵਾਉਣੀ ਪੈਂਦੀ ਹੈ ਔਰ ਮਤਲਬ ਕਿ ਜੋ ਅਸੀਂ ਘਰ ਸੀਅ ਸਕਦੇ ਹਾਂ ਉਹ ਘਰ ਦੀ ਹੀ ਚੀਜ਼ ਹੈ ਧੰਨਵਾਦ ਜੀ